ਸਤਿ ਸ਼੍ਰੀ ਅਕਾਲ ਜੀ ਮੈਂ ਰੋਪੜ ਜ਼ਿਲ੍ਹੇ ਤੋਂ ਵਾਰਡ ਨੰਬਰ ਇੱਕ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨਗਰ ਤੋਂ ਗੱਲ ਕਰ ਰਹੀ ਹਾਂ ਮੈਂ ਸਵੀਗੀ 'ਤੇ ਸਵੇਰੇ ਦਸ ਵਜੇ ਚਾਰ ਬਰਗਰ ਔਰ ਚਾਰ ਬਰਗਰ ਪੈਂਤੀ ਰੁਪਇਆਂ ਵਾਲੇ ਅਤੇ ਇੱਕ ਕੌਲਡ ਡਰਿੰਕ ਦੀ ਬੋਟਲ ਪੰਜਾਹ ਰੁਪਏ ਦੀ ਔਡਰ ਕੀਤੀ ਸੀ ਅਤੇ ਉਹਨਾਂ ਉਹ ਉਹ ਵਾਲਾ ਔਰਡਰ ਤੁਹਾਡੇ ਐਂਡ ਤੋਂ ਕੋਈ ਗਲਤੀ ਹੋ ਗਈ ਜਾਂ ਤੁਹਾਡੇ ਡਿਲੀਵਰੀ ਬੋਏ ਤੋਂ ਪਹੁੰਚਾਉਣ ਵਿੱਚ ਕੋਈ ਗਲਤੀ ਹੋ ਗਈ ਅਤੇ ਮੈਨੂੰ ਮੇਰਾ ਔਡਰ ਨਹੀਂ ਮਿਲ ਸਕਿਆ ਅਤੇ ਮੈਂ ਆਪਣਾ ਤੁਹਾਡੀ ਐਪ ਦੇ ਵਿੱਚ ਮਾਈ ਔਡਰ ਦੇ ਵਿੱਚ ਜਾ ਕੇ ਆਪਣੀ ਮਨੀਂ ਚੈੱਕ ਆਪਣੀ ਮਨੀ ਹੈ ਜਿਹੜੀ ਭੁਗਤਾਨ ਕੀਤੀ ਹੋਈ ਚੈੱਕ ਕੀਤੀ ਪਰ ਮੈਨੂੰ ਉੱਥੇ ਮੇਰੀ ਰਾਸ਼ੀ ਨਹੀਂ ਰਾਸ਼ੀ ਦਾ ਕੁਛ ਵੀ ਸੌਅ ਨਹੀਂ ਹੋਇਆ ਅਤੇ ਮੈਂ ਹੁਣ ਆਪ ਮੇਰੇ ਜ ਨਾ ਹੀ ਮੈਨੂੰ ਔਡਰ ਰਿਸ਼ੀਵ ਹੋਇਆ ਅਤੇ ਨਾ ਮੈਨੂੰ ਮੇਰੀ ਰਾਸ਼ੀ ਦੁਬਾਰਾ ਮਿਲੀ ਆ ਤਾਂ ਕਿਰ ਕਿਰਪਾ ਕਰਕੇ ਤੁਸੀਂ ਮੇਰੀ ਜਿਹੜੀ ਬਣਦੀ ਰਾਸ਼ੀ ਆ ਉਹ ਮੈਨੂੰ ਮੇਰੇ ਅਕਾਉਂਟ ਦੇ ਥਰੂਅ ਅਕਾਉਂਟ ਦੇ ਵਿੱਚ ਜਾਂ ਔਫਲਾਈਨ ਦਿੱਤੀ ਜਾਵੇ ਤਾਂ ਕਿ ਮੈਂ ਆਪਣਾ ਔਡਰ ਦੁਬਾਰਾ ਤੁਹਾਡੀ ਐਪ ਦੇ ਵਿੱਚ ਪਾ ਸਕਾਂ ਧੰਨਵਾਦ